ਕੰਮ ਤੋਂ ਬਾਅਦ ਮੈਂ ਬਾਹਰ ਜਾਣ ਦਾ ਮੈਨੂੰ ਬਹੁਤ ਸ਼ੌਂਕ ਰਹਿੰਦਾ ਬਾਹਰ ਸ਼ੋਪਿੰਗ ਕਰਨ ਦਾ ਜਿਵੇਂ ਜਾਂ ਘਰ 'ਚ ਹੀ ਕੋਈ ਕੁਕਿੰਗ ਕਰਨ ਦੀ ਕੋਈ ਕਢਾਈ ਸਲਾਈ ਇਸ ਤਰ੍ਹਾਂ ਦੇ ਕੰਮ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਅਤੇ ਬਾਹਰ ਜਾ ਕੇ ਵੀ ਜਿਵੇਂ ਮਾਰਕਿਟ ਗਏ ਹਾਂ ਤਾਂ ਮੈਨੂੰ ਬਹੁਤ ਚੀਜ਼ਾਂ ਦੇਖਣ ਵਿੱਚ ਮੈਨੂੰ ਬਹੁਤ ਅੱਛਾ ਲੱਗਦਾ ਏ ਕੋਈ ਕੱਪੜੇ ਹੋ ਗਏ ਜਾਂ ਕਿਚਨ ਦਾ ਸਮਾਨ ਹੋ ਗਿਆ ਇਹ ਚੀਜ਼ਾਂ ਵਿੱਚ ਮੈਨੂੰ ਬਹੁਤ ਜ਼ਿਆਦਾ ਅੱਛਾ ਲੱਗਦਾ ਕਿ ਘਰੇ ਵੀ ਕੰਮ ਤੋਂ ਬਾਅਦ ਵਿਹਲੇ ਹੁੰਦੇ ਹਾਂ ਤਾਂ ਬਾਹਰ ਕਿਚਨ ਨਾਲ਼ ਗਾਰਡਨ ਦਾ ਕੰਮ ਕਰ ਲਈਦਾ ਜਾਂ ਕੋਈ ਕਢਾਈ ਸਲਾਈ ਬੁਣਾਈ ਦਾ ਕੰਮ ਇਹ ਸਾਰੇ ਕੰਮ ਮੈਨੂੰ ਬਹੁਤ ਅੱਛੇ ਲੱਗਦੇ ਆ ਅਤੇ ਬਸ ਇੰਨਾ ਹੀ